ਫਿਊਜ਼ਨ ਪਕਵਾਨ ਤਾਂ ਅੱਜ ਕੱਲ੍ਹ ਬਹੁਤ ਫੇਮਸ ਹੋ ਗਏ ਹਨ ਹਰ ਇਨਸਾਨ ਨੂੰ ਫਿਊਜ਼ਨ ਪਕਵਾਨ ਬਹੁਤ ਪਸੰਦ ਆ ਰਹੇ ਹਨ ਮੈਂ ਵੀ ਆਪਣੇ ਘਰ ਵਿੱਚ ਫਿਊਜ਼ਨ ਪਕਵਾਨ ਬਣਾਉਂਦੀ ਹਾਂ ਜਿਵੇਂ ਮੈਂ ਡੋਸਾ ਬਣਾਇਆ ਸੀ ਡੋਸੇ ਦੇ ਵਿੱਚ ਅਸੀਂ ਪਾਇਆ ਸੀ ਪਿਆਜ਼ ਪਨੀਰ ਟਮਾਟਰ ਆਲੂ ਇਹ ਸਾਰੇ ਜਿਹੜੇ ਮਸਾਲੇੇ ਹੈ ਇਹ ਸਾਰਾ ਪਾ ਕੇ ਡੋਸਾ ਬਣਾਇਆ ਬਹੁਤ ਵਧੀਆ ਬਣਿਆ ਇਹਦਾ ਜਿਹੜਾ ਸਾਂਭਰ ਬਣਾਇਆ ਉਹਦੇ ਵਿੱਚ ਵੀ ਅਸੀਂ ਕਈ ਸਬਜ਼ੀਆਂ ਪਾਈਆਂ ਜਿਵੇਂ ਕੱਦੂ ਭਿੰਡੀ ਬੈਂਗਣ ਇਹ ਸਾਰੇ ਚੀਜ਼ਾਂ ਪਾ ਕੇ ਜਦੋਂ ਅਸੀਂ ਡੋਸੇ ਦਾ ਸਾਂਭਰ ਬਣਾਇਆ ਤਾਂ ਇਹਦਾ ਮਜ਼ਾ ਹੀ ਕੁਛ ਹੋਰ ਸੀ ਇਸ ਦੇ ਨਾਲ ਨਾਲ ਇੱਕ ਮੈਂ ਹੋਰ ਫਿਊਜ਼ਨ ਪਕਵਾਨ ਬਣਾਇਆ ਕੀਮਾ ਚਿਕਨ ਕੀਮਾ ਇਹਦੇ ਲਈ ਸਭ ਤੋਂ ਪਹਿਲਾਂ ਮੈਂ ਘਿਉ ਦੇ ਵਿੱਚ ਪਿਆਜ਼ ਅਤੇ ਅਦਰਕ ਨੂੰ ਲਸਣ ਨੂੰ ਭੁੰਨਿਆ ਫਿਰ ਉਹਦੇ ਵਿੱਚ ਚਿਕਨ ਕੀਮਾ ਪਾ ਕੇ ਉਹਨੂੰ ਥੋੜ੍ਹਾ ਜਿਹਾ ਭੁੰਨਿਆ ਫਿਰ ਟਮਾਟਰ ਛੋਟਾ ਛੋਟਾ ਚੋਪ ਕਰਕੇ ਟਮਾਟਰ ਪਾਇਆ ਨਮਕ ਚਿੱਲੀ ਫਲੇਕਸ ਪਾਏ ਔਰ ਥੋੜ੍ਹਾ ਜਿਹਾ ਔਰਗੈਨੋ ਪਾ ਕੇ ਉਹਨੂੰ ਥੋੜ੍ਹਾ ਜਿਹਾ ਭੁੰਨ ਕੇ ਉਹਨੂੰ ਇੱਕ ਸਾਈਡ 'ਤੇ ਰੱਖ ਦਿੱਤਾ ਫਿਰ ਇਹਦੇ ਲਈ ਅਸੀਂ ਇੱਕ ਵਾਈਟ ਸੋਸ ਤਿਆਰ ਕੀਤੀ ਜਿਹਦੇ ਵਿੱਚ ਮੈਂ ਮੱਖਣ ਪਾ ਕੇ ਇੱਕ ਪੈਨ ਦੇ ਵਿੱਚ ਮੱਖਣ ਪਾਇਆ ਫਿਰ ਉਹਦੇ ਵਿੱਚ ਮੈਦਾ ਪਾ ਕੇ ਥੋੜ੍ਹਾ ਭੁੰਨਿਆ ਉਹਨੂੰ ਥੋੜ੍ਹਾ ਗਾੜਾ ਕੀਤਾ ਫਿਰ ਉਹਦੇ ਵਿੱਚ ਦੁੱਧ ਪਾਇਆ ਦੁੱਧ ਪਾ ਕੇ ਉਹਨੂੰ ਥੋੜ੍ਹਾ ਗਾੜਾ ਕੀਤਾ ਫਿਰ ਨਮਕ ਪਾ ਕੇ ਉਹ ਜਿਹੜਾ ਮਿਸ਼ਰਨ ਹੈ ਵਾਈਟ ਸੋਸ ਮਿਸ਼ਰਨ ਉਹ ਜਿਹੜਾ ਤਿਆਰ ਹੋ ਗਿਆ ਫਿਰ ਇੱਕ ਕੱਚ ਦਾ ਬਾਊਲ ਲੈ ਕੇ ਉਹਦੇ ਵਿੱਚ ਮੈਂ ਉਹਨੂੰ ਥੋੜ੍ਹਾ ਮੱਖਣ ਲਗਾ ਕੇ ਰੱਖ ਦਿੱਤਾ ਮੱਖਣ ਲਗਾਉਣ ਤੋਂ ਬਾਅਦ ਫਿਰ ਉਹਦੇ ਵਿੱਚ ਮੈਂ ਕੀਮਾ ਪਾਇਆ ਕੀਮਾ ਪਾ ਕੇ ਥੋੜ੍ਹਾ ਜਿਹਾ ਕੀਮਾ ਪਾ ਕੇ ਫੈਲਾਅ ਦਿੱਤਾ ਫਿਰ ਉਹਦੇ ਉੱਪਰ ਮੋਜ਼ਰੇਲਾ ਚੀਜ਼ ਦੀ ਪਰਤ ਬਣਾਈ ਮੋਜ਼ਰੇਲਾ ਚੀਜ਼ ਪਾਉਣ ਤੋਂ ਬਾਅਦ ਫਿਰ ਮੈਂ ਇੱਕ ਉੱਪਰ ਕੀਮਾ ਪਾਇਆ ਕੀਮੇ ਤੋਂ ਬਾਅਦ ਫੇਰ ਮੋਜ਼ਰੇਲਾ ਚੀਜ਼ ਪਾਇਆ ਔਰ ਸਭ ਤੋਂ ਉੱਪਰ ਉਹਦੇ ਨਾਲ ਮੈਂ ਟਮਾਟੋ ਰੈੱਡ ਚਿਲੀ ਸੋਸ ਔਰ ਰੈੱਡ ਟਮੈਟੋ ਸੋਸ ਇਹ ਦੋਨੋਂ ਚੀਜ਼ਾਂ ਪਾ ਕੇ ਔਰ ਉੱਪਰ ਔਰਗੈਨੋ ਦਾ ਛਿੜਕਾਉ ਕੀਤਾ ਉਹਨੂੰ ਅਸੀਂ ਬੇਕ ਕੀਤਾ ਵੀਹ ਮਿੰਟ ਵਾਸਤੇ ਵੀਹ ਮਿੰਟ ਬੇਕ ਕਰਨ ਤੋਂ ਬਾਅਦ ਕਿਆ ਉਹ ਨਜ਼ਰ ਆ ਰਿਹਾ ਸੀ ਕਿਆ ਉਹਦਾ ਟੇਸਟ ਸੀ ਬਹੁਤ ਹੀ ਜ਼ਮੀ ਜਿਹੜਾ ਹਰ ਕਿਸੇ ਨੂੰ ਹੀ ਪਸੰਦ ਆਉਂਦਾ